ਭਾਰ ਵਧਾਉਣ ਦੇ ਕੁਝ ਘਰੇਲੂ ਨੁਕਤੇ ਹਨ ਕੇਲੇ ਖਾਓ ਡ੍ਰਾਈ ਫਰੂਟ ਦੁੱਧ ਅਤੇ ਸ਼ਹਿਦ ਘਿਓ ਅਤੇ ਗੁੜ ਜੌਂਆਂ ਦਾ ਸੇਵਨ ਆਦਿ ਤਰੀਕੇ ਹਨ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਜ਼ਿਆਦਾਤਰ ਜ਼ਿਆਦਾਤਰ ਘੱਟ ਭਾਰ ਦੋਵੇਂ ਹੀ ਸਿਹਤਮੰਦ ਦੇ ਹਾਨੀਕਾਕਰ ਹਨ ਘੱਟ ਭਾਰ ਹੋਣਾ ਸਰੀਰ ਦੀ ਸਥਿਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ ਕਈ ਬਿਮਾਰੀਆਂ ਨੂੰ ਖਤਰਾ ਇਹ ਪੈਦਾ ਕਰ ਸਕਦਾ ਹੈ ਇਸ ਲਈ ਸਿਹਤਮੰਦ ਬਣਾਈ ਰੱਖਣਾ ਜ਼ਰੂਰੀ ਹੈ ਆਓ ਜਾਣਦੇ ਹਾਂ ਭਾਰ ਵਧਾਉਣ ਦੇ ਕੁਝ ਤਰੀਕੇ ਕੇਲਾ ਭਾਰ ਵਧਾਉਣ ਤੋਂ ਫਾਇਦੇਮੰਦ ਮੰਨਿਆ ਜਾਂਦਾ ਹੈ ਜੇਕਰ ਕੇਲੇ ਦਾ ਸੇਵਨ ਦੁੱਧ ਨਾਲ ਕੀਤਾ ਜਾਵੇ ਤਾਂ ਭਾਰ ਵਧਾਉਣ ਵਿੱਚ ਮਦਦ ਕਰ ਸਕਦਾ ਹੈ ਕੇਲਾ ਕੈਲਸ਼ੀਅਮ ਪੋਟਾਸ਼ੀਅਮ ਅਤੇ ਵਿਟਾਮਿਨ ਬੀ ਦਾ ਚੰਗਾ ਸਰੋਤ ਹੈ ਸੇਵਨ ਕਰਨ ਨਾਲ ਤੁਸੀਂ ਸਰੀਰ ਨੂੰ ਊਰਜਾ ਤਾਂ ਮਹਿਸੂਸ ਕਰ ਸਕਦੇ ਹੋ ਅਤੇ ਕਸਰਤ ਕਰਦੇ ਸਮੇਂ ਤੁਹਾਨੂੰ ਥਕਾਵਟ ਮਹਿਸੂਸ ਨਹੀਂ ਹੁੰਦੀ ਦੁੱਧ ਦੀ ਬਜਾਏ ਤੁਸੀਂ ਦਹੀਂ ਅਤੇ ਨਾਲ ਕੇਲੇ ਦਾ ਸੇਵਨ ਕਰ ਸਕਦੇ ਹੋ ਰੋਜ਼ਾਨਾ ਤਿੰਨ ਤੋਂ ਚਾਰ ਕੇਲੇ ਆਪਣੀ ਡਾਈਟ ਵਿੱਚ ਸ਼ਾਮਲ ਕਰੋ ਡ੍ਰਾਈ ਫਰੂਟ ਸਿਹਤਮੰਦ ਚਰਬੀ ਨੂੰ ਇੱਕ ਵਧੀਆ ਤਰੀਕੇ ਸਿਹਤਮੰਦ ਤਰੀਕੇ ਨਾਲ ਭਾਰ ਵਧਾਉਣ ਵਿੱਚ ਮਦਦ ਕਰਦਾ ਹੈ ਇਨ੍ਹਾਂ ਦੀ ਕੈਲਰੀ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ ਇਸ ਲਈ ਤੁਹਾਡੇ ਰੋਜ਼ਾਨਾ ਬਦਾਮ ਕਾਜੂ ਅਤੇ ਅਖਰੋਟ ਨੂੰ ਪਾਣੀ ਵਿੱਚ ਭਿਓ ਕੇ ਅਗਲੇ ਦਿਨ ਦੁੱਧ ਨਾਲ ਖਾ ਸਕਦੇ ਹੋ ਉਬਾਲ ਕੇ ਦੁੱਧ 'ਚ ਪਾਓ ਅਤੇ ਭਾਰ ਵਧਾਓ ਜ਼ਿਆਦਾਤਰ ਫਾਇਦੇ ਮਿਲ ਸਕਦੇ ਹਨ ਪੀਸੇ ਹੋਏ ਬਦਾਮ ਖਾਣ ਨਾਲ ਵੀ ਭਾਰ ਵਧਣ ਲਈ ਮਦਦ ਕਰਦਾ ਹੈ ਦੁੱਧ ਅਤੇ ਸਿਹਤ ਪਤਲੇ ਲੋਕਾਂ ਲਈ ਵੀ ਸ਼ਹਿਦ ਦਾ ਸੇਵਨ ਫਾਇਦੇਮੰਦ ਹੋ ਸਕਦਾ ਹੈ ਦੁੱਧ ਸ਼ਹਿਦ ਮਿਲਾ ਕੇ ਪੀਣ ਨਾਲ ਭਾਰ ਵਧਣ ਦੀ ਮਦਦ ਕਰਦਾ ਹੈ ਸ਼ਹਿਦ ਤੱਤਾਂ ਨੂੰ ਵੀ ਕਰਦੇ ਹਨ ਇਸ ਤੋਂ ਪਹਿਲਾਂ ਤੁਹਾਨੂੰ ਦੁੱਧ ਦਾ ਉਬਾਲ ਲੈਣਾ ਅਤੇ ਕੁਝ ਦੇਰ ਬਾਅਦ ਉਬਲਦੇ ਹੋਏ ਦੁੱਧ 'ਚ ਚਾਰ ਪੰਜ ਚਮਚੇ ਸ਼ਹਿਦ ਮਿਲਾ ਕੇ ਰੋਜ਼ਾਨਾ ਤਾਕਤ ਰਾਤ ਨੂੰ ਸੌਣ ਵੇਲੇ ਪੀਓ ਭਾਰ ਵਧਣ ਨਾਲ ਤੁਹਾਡੇ ਕਮਿਊਟਟੀ ਵੀ ਵੱਧਦੀ ਰਹਿੰਦੀ ਹੈ ਗੁੜ ਅਤੇ ਘਿਓ ਜੇਕਰ ਤੁਹਾਡੇ ਘਰ ਦਾਦੀ ਜਾਂ ਨਾਨੀ ਦੀ ਹੈ ਤਾਂ ਤੁਸੀਂ ਪਿੰਡ ਵਿੱਚ ਕਿਸੇ ਰਹਿੰਦੇ ਤੋਂ ਤੁਹਾਡੇ ਅਜਿਹੇ ਨੁਸਖੇ ਬਹੁਤ ਸੁਣੇ ਹੋਣਗੇ ਇਹ ਨੁਸਖੇ ਕਾਫ਼ੀ ਕਾਰਗਰ ਹਨ ਭਾਰ ਵਧਾਉਣ ਲਈ ਮਦਦ ਕਰਦੇ ਹਨ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਪੀਣ ਨਾਲ ਨਾਲ ਗੁੜ ਖਾਂਦੇ ਹੋ ਜਾਂ ਤੁਹਾਡਾ ਭਾਰ ਵਧ ਜਾਂਦਾ ਮਦਦ ਕਰਦਾ ਹੈ ਇਸ ਦੇ ਕਾਰਨ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ ਤੁਹਾਡੀ ਕਮਿਊਨਟੀ ਸਿਸਟਮ ਨੂੰ ਵੀ ਮਜ਼ਬੂਤ ਬਣਾਉਂਦਾ ਹੈ ਜੌਂਆਂ ਦਾ ਸੇਵਨ ਕਰੋਗੇ ਤਾਂ ਭਾਰ ਵਧਾਉਣ ਲਈ ਜੌਂ ਵੀ ਬਹੁਤ ਫਾਇਦੇਮੰਦ ਹਨ ਜੌਂਆਂ ਨੂੰ ਭਿਓਂ ਕੇ ਰੱਖਣਾ ਚਾਹੀਦਾ ਹੈ ਇਸ ਨੂੰ ਪੀਸ ਕੇ ਛਿੱਲ ਕੇ ਛਿੱਲ ਲਓ ਅਤੇ ਜੌਂਆਂ ਨੂੰ ਦੁੱਧ ਵਿੱਚ ਮਿਲਾ ਕੇ ਉਬਾਲ ਕੇ ਖੀਰ ਬਣਾ ਕੇ ਖਾਧਾ ਜਾ ਸਕਦਾ ਹੈ ਇਹ ਖਾਣ ਨੂੰ ਸੁਆਦ ਵੀ ਹੁੰਦੀ ਹੈ ਅਤੇ ਸੇਵਨ ਨਾਲ ਤੁਹਾਨੂੰ ਕਾਫ਼ੀ ਫਾਇਦੇ ਵੀ ਮਿਲਦੇ ਹਨ ਪਤਲੇ ਲੋਕਾਂ ਨੂੰ ਸਿਹਤਮੰਦ ਤਰੀਕੇ ਨਾਲ ਭਾਰ ਵਧਾਉਣ ਲਈ ਜੌਂਆਂ ਦਾ ਸੇਵਨ ਕਰਨਾ ਚਾਹੀਦਾ ਹੈ ਵਜਨ ਵਧਾਉਣ ਦੇ ਨਾਲ ਨਾਲ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਸਿਹਤਮਬੰਦ ਤਰੀਕਿਆਂ ਨਾਲ ਹੀ ਵਰਤੋਂ ਭਾਰ ਵਧਾ ਕੇ ਕਰ ਸਕਦੇ ਹੋ ਨਹੀਂ ਤਾਂ ਸਰੀਰ ਅਸਥਿਰ ਹੋ ਸਕਦਾ ਹੈ ਸਮੱਸਿਆ ਤੋਂ ਪੀੜਤ ਅਤੇ ਭਾਰ ਵਧਾਉਣ ਲਈ ਇੱਕ ਨਵਾਂ ਖੁਰਾਕ ਅਤੇ ਕਸਰਤ ਪ੍ਰੋਗਰਾਮ ਸ਼ੁਰੂ ਕਰਨਾ ਚਾਹੀਦਾ ਦੀ ਯੋਜਨਾ ਬਣਾ ਲਓ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ